ਸਾਈਕਲ ਦੇ ਰਾਹੀਂ ਤਾਂ ਤਾਂ ਮੈਂ ਇੱਥੇ ਭਾਰਤ ਦੇ ਵਿੱਚ ਕੁਛ ਆਪਣੇ ਪੰਜਾਬ ਦੇ ਵਿੱਚ ਲੋਕਲ ਥਾਵਾਂ 'ਤੇ ਜ਼ਿਆਦਾ ਸਫਰ ਕੀਤਾ ਵਾ ਜਿਵੇਂ ਕਿ ਅਸੀਂ ਇਸ ਥਾਂ ਲਗਾ ਲਈਏ ਵੀ ਛੇਹਰਾਟੇ ਦੇ ਉੱਤੋਂ ਅਟਾਰੀ ਚਲੇ ਗਏ ਅਟਾਰੀਓਂ ਦਰਬਾਰ ਸਾਹਿਬ ਗੋਲਡਨ ਡਵ ਗੋਲਡਨ ਟੈਂਪਲ ਚਲੇ ਗਏ ਗੋਲਡਨ ਟੈਂਪਲ ਤੋਂ ਜਾਂ ਇੱਧਰ ਮਾਨਾ ਵਾਲੇ ਤੱਕ ਚਲੇ ਗਏ ਗੋਲਡਨ ਗੇਟ ਚਲੇ ਗਏ ਹੋਰ ਇੱਥੇ ਜੰਡਿਆਲੇ ਵੱਲ ਗਏ ਆਪਾਂ ਸਾਈਕਲ ਦੇ ਰਾਹੀਂ ਸਾਈ ਤਰਨ ਤਾਰਨ ਚਲੇ ਗਏ ਹੋਰ ਇੱਧਰ ਆਪਣਾ ਪਿੰਡਾਂ ਦੇ ਵੱਲ ਢੰਡ ਕਿਸੇ ਲਵਾਇਆ ਹੋ ਗਿਆ ਹੋਰ ਕੋਈ ਹੋ ਗਿਆ ਬਾਕੀ ਜਿਹੜੀ ਗੱਲ ਕਰੀਏ ਕਿ ਅਸੀਂ ਜਲਦੀ ਜਾਣਾ ਚਾਹੁੰਦੇ ਕਿਉਂਕਿ ਹੁਣ ਅਸੀਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਸਾਈਕਲ ਚਲਾ ਚਲਾ ਕੇ ਲੰਘਾ ਦਿੱਤੀ ਅਤੇ ਹੁਣ ਜ਼ਿਆਦਾ ਕੋਈ ਸ਼ੌਕ ਸਾਡਾ ਰਹਿ ਨਹੀਂ ਗਿਆ ਵੀ ਸਾਇਕਲਾਂ ਚਲਾਉਣ ਦਾ ਅਤੇ ਹੋਰ ਤਾਂ ਆਪਾਂ ਕਿਤੇ ਜਾਣਾ ਨਹੀਂ ਚਾਹੁੰਦੇ ਹੈਗੇ ਸਾਈਕਲ